ਵੈਸੇ ਤਾਂ ਪੰਜਾਬ ਦੀਆਂ ਸੜਕਾਂ ਬਹੁਤ ਵਧੀਆ ਹਨ ਪਰ ਕਿਤੇ ਕਿਤੇ ਬਹੁਤ ਖਰਾਬ ਵੀ ਹਨ ਜਿਵੇਂ ਕਿ ਤੁਸੀਂ ਮਲੋਟ ਤੋਂ ਮੁਕਤਸਰ ਦੀ ਹੀ ਸੜਕ ਲਾ ਲਓ ਇਹ ਬਹੁਤ ਖਰਾਬ ਹੋਈ ਵੀ ਹੈ ਇਸ ਵਿੱਚ ਵੱਡੇ ਵੱਡੇ ਖੱਡੇ ਹੋਏ ਹੋਏ ਹਨ ਲੋਕਾਂ ਨੂੰ ਆਉਣ ਜਾਣ ਵੇਲੇ ਬਹੁਤ ਤਕਲੀਫ ਹੁੰਦੀ ਹੈ ਜਦੋਂ ਸਰਕਾਰ ਨੇ ਵਿੱਚ ਜੇ ਇਹਨਾਂ ਨੂੰ ਠੀਕ ਵੀ ਕਰਾਇਆ ਸੀ ਇਹਨਾਂ ਵਿੱਚ ਮਿੱਟੀ ਪਾ ਕੇ ਪਾ ਦਿੱਤੀ ਸੀਗੀ ਜਿਸ ਨਾਲ ਖੱਡੇ ਕਰ ਉਹਨਾਂ ਨੇ ਬੰਦ ਕਰ ਦਿੱਤੇ ਸੀ ਪਰ ਲੋਕਾਂ ਨੂੰ ਇਸ ਨਾਲ ਹੋਰ ਵੀ ਤਕਲੀਫ ਹੋਣ ਲੱਗ ਪਈ ਲੋਕੀ ਜਦੋਂ ਆਉਂਦੇ ਜਾਂਦੇ ਸੀ ਤਾਂ ਉਹਨਾਂ ਉੱਤੇ ਮਿੱਟੀ ਉੱਡਦੀ ਸੀਗੀ ਜਿਸ ਨਾਲ ਉਹਨਾਂ ਨੂੰ ਹੋਰ ਵੀ ਤਕਲੀਫ ਹੁੰਦੀ ਸੀ ਸੜਕ ਵਿੱਚ ਜਿਹੜੇ ਵੱਡੇ ਗੱਡੇ ਹਨ ਉਹਨਾਂ ਨਾਲ ਐਕਸੀਡੈਂਟ ਹੋਣ ਦਾ ਡਰ ਬਣਿਆ ਰਹਿੰਦਾ ਹੈ ਸਰਕਾਰ ਨੂੰ ਇਨਾ ਬਾਰੇ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਕੀ ਲੋਕਾਂ ਨੂੰ ਜਦੋਂ ਸੜਕਾਂ ਖਰਾਬ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਇਧਰ ਉਧਰ ਜਾਣ ਵੇਲੇ ਕਿੰਨੀ ਤਕਲੀਫ ਹੁੰਦੀ ਹੈ ਸਰਕਾਰ ਨੂੰ ਅਜਿਹੀਆਂ ਸੜਕਾਂ ਜਦੋਂ ਖਰਾਬ ਹੁੰਦੀਆਂ ਹਨ ਤਾਂ ਉਹਨਾਂ ਨੂੰ ਨਾਲ ਦੀ ਨਾਲ ਹੀ ਠੀਕ ਕਰਵਾ ਦੇਣਾ ਚਾਹੀਦਾ ਹੈ ਕੀ ਤਾਂ ਕੀ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਲੋਕੀ ਆਰਾਮ ਨਾਲ ਆਪਦਾ ਸਫਰ ਕਰ ਸਕਣ ਸਰਕਾਰ ਨੂੰ ਇਸ ਚੀਜ਼ਾ ਬਾਰੇ ਸੋਚਣਾ ਚਾਹੀਦਾ ਹੈ ਸੋ ਲੋਕਾਂ ਨੂੰ ਇਸ ਨਾਲ ਕੋਈ ਤਕਲੀਫ ਨਹੀਂ ਹੁੰਦੀ ਪੰਜਾਬ ਦੀ ਸੜਕਾਂ ਵਹਿਤਾ ਠੀਕ ਹੀ ਹਨ ਪਰ ਇਨਾ ਨਾਲ ਬਹੁਤ ਤਕਲੀਫ ਵੀ ਹੁੰਦੀ ਹੈ ਲੋਕਾਂ ਨੂੰ ਜਦੋਂ ਸੜਕ ਖਰਾਬ ਹੋ ਜਾਂਦੀ ਹੈ ਕਈ ਵਾਰ ਉਹ ਕਿਤੇ ਪਹੁੰਚਣ ਵੇਲੇ ਲੇਟ ਵੀ ਹੋ ਜਾਂਦੇ ਹਨ ਸੋ ਪੰਜਾਬ ਦੀਆਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਸੜਕਾਂ ਦੇ ਖਰਾਬ ਹੋਣਾ ਤਾਂ ਉਹਨਾਂ ਨੂੰ ਜੀ ਸੜਕਾਂ ਜਦੋਂ ਖਰਾਬ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਨਾਲ ਦੀ ਨਾਲ ਠੀਕ ਕਰਵਾ ਦੇਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ